ਮੈਂ ਕੱਪੜੇ ਧੋਣ ਲਈ ਦੋ ਚੀਜ਼ਾਂ ਵਰਤਦਾ ਹਾਂ ਜਿੱਦਾਂ ਕਿ ਮੈਂ ਸਵੇਰੇ ਨਹਾਨਾ ਹਾਂ ਅਤੇ ਮੈਂ ਜਿਹੜੇ ਆਪਣੇ ਕੱਪੜੇ ਆ ਉਹ ਹੱਥ ਦੇ ਨਾਲ ਧੋਨਾ ਜਿੱਦਾਂ ਮੈਂ ਹੱਥ ਨਾਲ ਸਾਬਣ ਲਾਨਾ ਉਸ ਤੋਂ ਬਾਅਦ ਮੈਂ ਹੱਥ ਵਾਲੇ ਬਰਸ਼ ਨਾਲ ਉਹਨੂੰ ਉਹ ਸਾਫ ਕਰਕੇ ਫਿਰ ਪਾਣੀ 'ਚ ਹ ਹੰਗਾਲ ਕੇ ਫਿਰ ਨਿਚੋੜ ਕੇ ਰੱਖ ਦਿੰਦਾ ਹਾਂ ਨਹਾਉਣ ਤੋਂ ਬਾਅਦ ਫਿਰ ਮੈਂ ਆਪਣੇ ਕੱਪੜਿਆਂ ਨੂੰ ਤਾਰ 'ਤੇ ਸੁੱਕਣ ਵਾਸਤੇ ਪਾ ਦਿੰਦਾ ਵਾ ਅਤੇ ਦੂਜਾ ਮੈਂ ਇੱਦਾਂ ਕਰਦਾ ਹਾਂ ਕਿ ਮੇਰੇ ਜਦ ਕੱਪੜੇ ਇਕੱਠੇ ਹੋ ਜਾਂਦੇ ਨੇ ਅਤੇ ਮੈਂ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਣੀ ਭਰ ਕੇ ਅਤੇ ਉਹਦੇ ਵਿੱਚ ਸਰਫ ਪਾ ਕੇ ਫਿਰ ਮੈਂ ਆਪਣੇ ਕੱਪੜੇ ਉਹਦੇ ਵਿੱਚ ਘੁੰਮਾਨਾ ਹਾਂ ਘੁੰਮਾਨ ਤੋਂ ਬਾਅਦ ਫਿਰ ਮੈਂ ਸਪਿਨਰ ਦੇ ਵਿੱਚ ਪਾਨਾ ਹਾਂ ਉਸ ਤੋਂ ਬਾਅਦ ਪਾਣੀ ਛੱਡ ਕੇ ਉਹ ਤਕਰੀਬਨ ਸੁੱਕ ਜਾਂਦੇ ਹੈ ਉਸ ਤੋਂ ਬਾਅਦ ਮੈਂ ਬਾਲਟੀ 'ਚ ਕੱਪੜੇ ਪਾ ਕੇ ਉਹਨੂੰ ਬਾਹਰ ਜਾ ਕੇ ਤਾਰ ਉੱਤੇ ਸੁੱਕਣੇ ਪਾ ਦਿੰਦਾ ਹਾਂ ਅਤੇ ਉਸ ਤੋਂ ਬਾਅਦ ਕੀ ਹੈ ਉਹਨੂੰ ਜਦ ਕੱਪੜਿਆਂ ਨੂੰ ਧੁੱਪ ਲੱਗ ਜਾਂਦੀ ਹੈ ਕੱਪੜੇ ਸੁੱਕ ਜਾਂਦੇ ਆ ਫਿਰ ਉਸ ਤੋਂ ਬਾਅਦ ਕੱਪੜੇ ਤਾਰ ਤੋਂ ਉਤਾਰ ਕੇ ਉਹਨੂੰ ਤੈਅ ਲਾ ਕੇ ਆਪਣੀ ਅਲਮਾਰੀ 'ਚ ਰੱਖ ਦਿੰਦਾ ਹਾਂ ਆਹ ਆਹ ਤਰੀਕੇ ਨਾਲ ਅਸੀਂ ਕੱਪੜੇ ਧੋਨੇ ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਇਹਦੇ ਵਿੱਚ ਕੀ ਹੁੰਦਾ ਹੈ ਕਿ ਉੱਥੇ ਆਟੋਮੈਟਿਕ ਮਸ਼ੀਨਾਂ ਹੁੰਦੀਆਂ ਹਨ ਉਹਦੇ ਵਿੱਚ ਕੱਪੜੇ ਧੁਲ ਕੇ ਸੁੱਕ ਕੇ ਬਾਹਰ ਆਉਂਦੇ ਹਨ ਉਸ ਤੋਂ ਬਾਅਦ ਉਹ ਡਰੈਅਰ ਦੇ ਵਿੱਚ ਪਾ ਦਿੰਦੇ ਹਨ ਕਿਉਂਕਿ ਉੱਥੇ ਬਾਰਸ ਬਾਹਰ ਸੁਕਾਨ ਦਾ ਸਿਸਟਮ ਨਹੀਂ ਹੈ ਤਾਂ ਕਰਕੇ ਉੱਥੇ ਡਰਾਇਰ ਹੁੰਦੇ ਹਨ ਉਹ ਡਰਾਇਰ ਦੇ ਵਿੱਚ ਗਰਮ ਹਵਾ ਮਾਰਦੇ ਹਨ ਤੇ ਕੱਪੜੇ ਸੁੱਕ ਜਾਂਦੇ ਹਨ